ਹਾਂ ਭਾਰਤ ਹਾਲੇ ਉੱਦਮ ਵਿੱਚ ਉਣਤੀਆਂ ਲਈ ਇੱਕ ਸੁਨਹਿਰਾ ਯੁੱਗ ਜੀਅ ਰਿਹਾ ਹੈ ਸਟਾਰਟਅਪ ਬੂਮ ਦੋ ਹਜ਼ਾਰ ਛੱਬੀ ਤੋਂ ਬਾਅਦ ਭਾਰਤ ਵਿਸ਼ਵ 'ਚ ਤੀਜਾ ਸਭ ਤੋਂ ਵੱਡਾ ਸਟਾਰਟਅਪ ਈਕੋਸਿਸਟਮ ਬਣ ਗਿਆ ਹੈ ਯੂ ਪੀ ਆਈ ਡੀ ਸੀਟਲ ਇੰਡੀਆ ਅਤੇ ਫੈਂਟੈਕ ਸਟਾਰਟਅਪ ਨੇ ਨਵੇਂ ਉਮਦਿਆ ਨੂੰ ਆਸਾਨੀ ਨਾਲ ਸਕੇਲ ਕਰਨ ਦਾ ਮੌਕਾ ਦਿੱਤਾ ਸਟਾਰਟਅਪ ਇੰਡੀਆ ਮੇਕ ਇਨ ਇੰਡੀਆ ਅਤੇ ਮੁੱਦਰਾ ਲੋਨ ਵਰਗੀਆ ਨੀਤੀਆਂ ਨਵੇਂ ਵਪਾਰੀਆਂ ਨੂੰ ਆਸਾਨੀ ਨਾਲ ਵਧਣ ਵਿੱਚ ਮਦਦ ਕਰ ਰਹੀਆਂ ਹਨ ਭਾਰਤ ਵਿੱਚ ਮਨੇਜਰ ਕੈਪਟਲਾਈਜ਼ੇਸ਼ਨ ਐਂਡ ਏਂਜਲ ਇਨਵੈਸਟਰ ਵੱਲੋਂ ਭਾਰੀ ਨਿਵੇਸ਼ ਆ ਰਿਹਾ ਹੈ ਨਵੇਂ ਸਟਾਰਟਅਪ ਨੂੰ ਟੈਕਸ ਹੋਲੀਡੇ ਤੀਨ ਸਾਲ ਤੱਕ ਟੈਕਸ ਮੁਕਤ ਅਤੇ ਸਰਲ ਰਜਿਸਟਰੇਸ਼ਨ ਦੀ ਸੁਵਿਧਾ ਫੰਡ ਓਫ ਫੋਡਸ ਜ਼ਰੀਏ ਸਰਕਾਰ ਨੇ ਵੀ ਸੀ ਫੰਡ ਨੂੰ ਹੋਰ ਮਜ਼ਬੂਤ ਕੀਤਾ ਛੋਟੇ ਵਪਾਰਿਕ ਐਮ ਐਸ ਐਮ ਈਸ ਨੂੰ ਪੰਜਾਹ ਹਜ਼ਾਰ ਤੋਂ ਦਸ ਲੱਖ ਤੱਕ ਦੇ ਬਿਨ੍ਹਾਂ ਜ਼ਮਾਨਤ ਕਰਜ਼ੇ ਭਾਰਤ 'ਚ ਅਗਲੇ ਦਸ ਸਾਲਾਂ 'ਚ ਸਟਾਰਟਅਪ ਲਈ ਬਿਲਕੁਲ ਹੁਣ ਸਟਾਰਟਅਪ ਅਤੇ ਨਵੇਂ ਉੱਦਮਾਂ ਲਈ ਇਤਿਹਾਸਿਕ ਮੌਕਾ ਹੈ ਸਰਕਾਰ ਟੈਕਨੋਲਜੀ ਡਿਜੀਟਲ ਇਕਨੋਮਿਕ ਅਤੇ ਗਲੋਬਲ ਮਾਰਕਿਟ ਟਰੇਂਡ ਨੇ ਭਾਰਤ ਨੂੰ ਇੱਕ ਉਦਮ ਕੇਂਦਰਿਤ ਈਕੋਸਿਸਟਮ ਬਣਾ ਦਿੱਤਾ ਹੈ